ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਕੋਲ ਜੀ ਵੱਡੇ ਬਰਤਨ ਚਾਹੀਦੇ ਆ ਕਿ ਛੋਟੇ ਬਰਤਨ ਚਹੀਦੇ ਆ ਜੀ ਅੱਛਾ ਜੀ ਸਾਡੇ ਕੋਲ ਨਾ ਜੀ ਵੱਡੇ ਬਰਤਨ ਹੈ ਜੋ ਇੱਕ ਤਾਂ ਵੱਡੇ ਕੜਾਹੇ ਹੈਗੇ ਆ ਉਹਨਾਂ ਦੇ ਨਾਲ ਛੋਟੀਆਂ ਕੜਾਹੀਆਂ ਵੀ ਹੈਗੀਆਂ ਸਾਡੇ ਕੋਲ ਵੱਡੇ ਧਾਮੇ ਹੈਗੇ ਹੈ ਵੱਡੀਆਂ ਪ੍ਰਾਂਤਾਂ ਹੈਗੀਆਂ ਆਟਾ ਗੁੰਨਣ ਵਾਸਤੇ ਤੇ ਇਹ ਆਪਣੇ ਕੋਲ ਇਹ ਭਾਂਡੇ ਬਰਤਨ ਪਤੀਲੇ ਹੈਗੇ ਆ ਵੱਡੇ ਮਤਲਬ ਕਿ ਅਤੇ ਹਾਂਜੀ ਅਤੇ ਆਪਣੇ ਕੋਲ ਵੱਡੀਆਂ ਤਵੀਆਂ ਹੈਗੀਆਂ ਜੀ ਜਿਹੜੀਆਂ ਗੈਸ ਸਿਲੰਡਰ 'ਤੇ ਮਤਲਬ ਭੱਠੀਆਂ ਸਲੰਡਰ 'ਤੇ ਜਿਹੜੀਆੰ ਭੱਠੀਆਂ ਚੱਲੀਆਂ ਨਾ ਅੱਜ ਕੱਲ੍ਹ ਉਹਨਾਂ 'ਤੇ ਰੱਖਣ ਨੂੰ ਵੱਡੀਆਂ ਤਵੀਆਂ ਵੀ ਹੈਗੀਆਂ ਜੀ ਆਪਣੇ ਕੋਲ ਹਾਂਜੀ ਹਾਂਜੀ

ਹਾਂਜੀ ਛੋਟੇ ਬਰਤਨ ਦੇ ਵਿੱਚ ਆਪਣੇ ਕੋਲ ਚਾਰ ਕੋਲੀਆਂ ਵਾਲੀਆਂ ਪਲੇਟਾਂ ਹੈਗੀਆਂ ਵੱਡੀਆਂ ਚਾਰ ਕੋਲੀਆਂ ਵਾਲੀਆਂ ਪਲੇਟਾਂ ਹੈਗੀਆਂ ਚਮਚੇ ਹੈਗੇ ਆ ਸਬਜ਼ੀਆਂ ਪਾਉਣ ਵਾਸਤੇ ਬਾਲਟੀਆਂ ਹੈਗੀਆਂ ਕੜਛੀਆਂ ਹੈਗੀਆਂ ਅਤੇ ਚਾਰ ਵਾਲੀਆਂ ਕੇਤਲੀਆਂ ਹੈਗੀਆਂ ਜੀ ਆਪਣੇ ਕੋਲ ਚਮਚੇ ਹੈਗੇ ਆ ਜੀ ਅਤੇ ਤੁਹਾਨੂੰ ਮਤਲਬ ਕਿਹੜੇ ਚਾਹੀਦੇ ਆ ਜੀ ਹਾਂਜੀ ਹਾਂਜੀ ਹਾਂਜੀ ਇਹ ਸਾਰਾ ਕੁਛ ਹੈਗਾ ਜੀ ਆਪਣੇ ਕੋਲ ਜੱਗ ਜੁਗ ਇਹ ਸਾਰੇ ਬਰਤਣ ਹੈਗੇ ਹੈ ਜੀ ਛੋਟੇ ਵੱਡੇ ਅਤੇ ਤੁਸੀਂ ਮਤਲਬ ਅਤੇ ਤੁਹਾਨੂੰ ਕਿਹੜੇ ਚਾਹੀਦੇ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਓਹ ਕੋਈ ਗੱਲ ਨਹੀਂ ਜੀ ਤੁਸੀਂ ਆਜੋ ਜੀ ਆਪਾਂ ਜਦੋਂ ਤੁਸੀਂ ਸਾਡੇ ਕੋਲ ਆਓਗੇ ਠੀਕ ਹੈ ਤੇ ਵੱਡੇ ਬਰਤਨ ਲੈਣੇ ਹੋਏ ਤਾਂ ਵੱਡੇ ਬਰਤਨ ਕਢਵਾ ਕੇ ਸਾਰੇ ਦੇਖ ਲਿਓ ਜੀ ਅਤੇ ਛੋਟੇ ਚਾਹੀਦੇ ਹੋਏ ਛੋਟੇ ਕਢਵਾ ਕੇ ਵੇਖਦੇ ਸੀ ਜਿਹੜੇ ਤੁਹਾਨੂੰ ਚਾਹੀਦੇ ਹੋਏ ਤਾਂ ਦੁਕਾਨ 'ਚ ਆ ਕੇ ਸਾਨੂੰ ਦੱਸ ਦਿਓ ਜੇ ਅਤੇ ਅਸੀਂ ਫਿਰ ਐਂ ਨਾ ਜੀ ਲਾ ਕੇ ਮਤਲਬ ਕਿ ਕਰਮਚਾਰੀ ਨੂੰ ਜਿਹੜਾ ਸਾਡੇ ਦੁਕਾਨ 'ਤੇ ਲੱਗੇ ਹੋਏ ਆ ਮੁੰਡੇ ਉਹਨਾਂ ਨੂੰ ਲਾ ਕੇ ਅਤੇ ਉਹ ਬਰਤਨ ਅਸੀਂ ਸਾਰੇ ਸਾਫ਼ ਕਰਵਾ ਕੇ ਠੀਕ ਹੈ ਜੀ ਅਤੇ ਉਹ ਰੱਖ ਦੇਵਾਂਗੇ ਅਸੀਂ ਠੀਕ ਹੈ ਜੀ ਤੁਸੀਂ ਸਾਨੂੰ ਦੱਸ ਦਿਓ ਜੀ ਕਿਹੜੇ ਕਿਹੜੇ ਚਾਹੀਦੇ ਹੈਗੇ ਹੈ ਤੁਸੀਂ ਸਾਡੀ ਦੁਕਾਨ 'ਤੇ ਆ ਜਾਇਓ ਜੀ ਠੀਕ ਹੈ ਜੀ ਅਤੇ ਹਾਂਜੀ ਹਾਂਜੀ ਦੇਗੇ ਵੀ ਹੈਗੇ ਹੈ ਜੀ ਉਹ ਐਂ ਨਾ ਜੀ ਤਾਂਹੀਓ ਤਾਂ ਦੇਗੇ ਧਾਮੇ ਵੱਡੇ ਅਤੇ ਲੋਹੇ ਦੀਆਂ ਕੜਾਹੀਆਂ ਜਿਵੇਂ ਆਪਾਂ ਮਤਲਬ ਕਿ ਚਾਹੀਦੀਆਂ ਹੁੰਦੀਆਂ ਆਪਾਂ ਨੂੰ ਕਈ ਵਾਰ ਉਹ ਵੀ ਹੈਗੀਆਂ ਸਬਜ਼ੀਆਂ ਵਾਲੇ ਵੱਡੇ ਵੱਡੇ ਧਾਮੇ ਵੀ ਹੈਗੇ ਆਪਣੇ ਕੋਲ ਅਤੇ ਕੜਛੀਆਂ ਹੈਗੀਆਂ ਅਤੇ ਛੋਟੇ ਭਾਂਡੇ ਵੀ ਹੈਗੇ ਹੈ ਜਿਵੇਂ ਥਾਲੀਆਂ ਚਮਚੇ ਗਲਾਸ ਕੌਲੀਆਂ ਕੌਲੀਆਂ ਵੀ ਓਵਰ ਦੇ ਦਿੰਦੇ ਹਾਂ ਨਾਲ ਅਸੀਂ ਹਾਂਜੀ ਹਾਂਜੀ ਅਤੇ ਅਸੀਂ ਨਾਲ ਮਤਲਬ ਚਮਚੇ ਚੁਮਚੇ ਸਾਰੇ ਸਾਫ਼ ਕਰਕੇ ਦੇਵਾਂਗੇ ਗਿਣਤੀ ਕਰਕੇ ਜੱਗ ਦੇ ਦਿਆਂਗੇ ਨਾਲ ਤੁਹਾਨੂੰ ਠੀਕ ਹੈ ਜੀ ਗਲਾਸ ਦੇ ਦਿਆਂਗੇ ਥਾਲੀਆਂ ਦੇ ਦਿਆਂਗੇ ਜਿੰਨਾਂ ਵੀ ਮਤਲਬ ਬਰਤਨ ਆਪਾਂ ਨੂੰ ਲੋੜੀਦੇ ਹੋਏ ਨਾ ਮਤਲਬ ਕਿ ਸਾਰੇ ਦੇ ਦਿਆਂਗੇ ਉਹ ਅਤੇ ਤੁਸੀਂ ਤੁਸੀਂ ਦੁਕਾਨ 'ਤੇ ਆ ਜਾਇਓ ਜੀ ਅਤੇ ਆਪਾਂ ਕੋਈ ਗੱਲ ਨਹੀਂ ਜੀ ਤੁਹਾਨੂੰ ਡਿਸਕਾਊਂਟ 'ਤੇ ਹੀ ਦੇ ਦਿਆਂਗੇ ਜੀ ਸਾਰੇ ਭਾਂਡੇ ਬਰਤਨ ਜਿਹੜੇ ਵੱਡੇ ਛੋਟੇ ਜਿਹੜੇ ਲੈਣੇ ਹੋਏ ਠੀਕ ਹੈ ਜੀ ਠੀਕ ਹੈਂ ਜੀ ਸਤਿ ਸ਼੍ਰੀ ਅਕਾਲ ਜੀ